ਹਾਂਜੀ ਸਰ ਹਾਂਜੀ ਹਾਂਜੀ ਕਿਹੜੀ ਸਰ ਜੀ ਹਾਂਜੀ ਬੋਲੋ ਸਰ ਜੀ ਸਰ ਅਸੀਂ ਰਾਧਾ ਸੁਆਮੀ ਕਲੋਨੀ ਦੇ ਰਹਿਣ ਵਾਲੇ ਹਾਂ ਜੀ ਹਾਂਜੀ ਸਰ ਸਰ ਜੀ ਸਾਡੀ ਕਲੋਨੀ ਦੇ ਵਿੱਚ ਤਾਂ ਮਤਲਬ ਇਹ ਹੀ ਸਮਝ ਲਓ ਕੋਈ ਨੱਬੇ ਪਰਸੈਂਟ ਤੋਂ ਤਾਂ ਸਮਝ ਲਿਓ ਵੀ ਅਣਪੜ੍ਹ ਹੀ ਹੋਣਗੇ ਕੋਈ ਦਸ ਪਰਸੈਂਟ ਪੜ੍ਹੇ ਲਿਖੇ ਜਿਹਨਾਂ ਵਿੱਚੋਂ ਅੱਧੇ ਤਾਂ ਸਮਝ ਲਓ ਵੀ ਨਸ਼ਿਆਂ ਦੇ ਵਿੱਚ ਡੁੱਬੇ ਪਏ ਨੇ ਕੋਈ ਅੰਧ ਵਿਸ਼ਵਾਸ ਦੇ ਵਿੱਚ ਡੁੱਬਿਆ ਪਿਆ ਅਤੇ ਸਮਝ ਲਓ ਵੀ ਗਲੀ ਮੁਹੱਲੇ ਦਾ ਹਾਲ ਵੀ ਉਹ ਰਹਿ ਨਹੀਂ ਗਿਆ ਜਿਵੇਂ ਦਾ ਪਹਿਲਾਂ ਦਾ ਸੀਗਾ ਉਹੋ ਜਿਹਾ ਤਾਂ ਰਹਿ ਨਹੀਂ ਗਿਆ ਅੱਧੇ ਅੰਧ ਵਿਸ਼ਵਾਸ ਦੇ ਵਿੱਚ ਬੜੇ ਪਏ ਨੇ ਜਿਵੇਂ ਕੋਈ ਟੂਣੇ ਟਪੂਣੇ ਜਿਹੇ ਕਰ ਲਏ ਅੱਜ ਕੱਲ੍ਹ ਤਾਂ ਲੋਕ ਸਰ ਜੀ ਇਸ ਤਰ੍ਹਾਂ ਦੇ ਹੋਏ ਪਏ ਨੇ ਜੀ ਮੰਨ ਲਓ ਜਿਵੇਂ ਕੋਈ ਕਿਸੇ ਨੇ ਵਹਿਮ ਪਾ ਦਿੱਤਾ ਜੇ ਕੋਈ ਬਿਮਾਰ ਹੋ ਗਿਆ ਜੇ ਘਰਦਿਆਂ ਨੇ ਵਹਿਮ ਪਾ ਦਿੱਤਾ ਤੈਨੂੰ ਝਾੜੇ ਲਵਾ ਲਓ ਧਾਗੇ ਬਨਵਾ ਲਓ ਤਵੀਜ ਬਨਵਾ ਲਓ ਅੱਜ ਕੱਲ੍ਹ ਦੇ ਉਹ ਚੀਜ਼ ਜ਼ਿਆਦਾ ਚੱਲਦੀ ਪਈ ਹੈ ਡਾਕਟਰ ਵਾਲੇ ਪਾਸੇ ਭੱਜਦੇ ਪਏ ਭੱਜਦੇ ਨਹੀਂ ਪਏ ਅਤੇ ਧਾਗੇ ਤਵੀਤਾਂ ਵੱਲ ਭੱਜਦੇ ਪਏ ਨੇ ਜਦੋਂ ਉਧਰ ਕੋਈ ਕੰਮ ਨਹੀਂ ਬਣਦਾ ਫਿਰ ਕਿਸੇ ਦੂਸਰੇ ਵਾਲੇ ਪਾਸੇ ਵੜ ਜਾਂਦੇ ਸਾਡੀ ਕਲੋਨੀ ਵਿੱਚ ਇਹ ਚੀਜ਼ ਤਾਂ ਬਹੁਤ ਹੀ ਜ਼ਿਆਦਾ ਵੇਖਣ ਨੂੰ ਮਿਲਦੀ ਪਈ ਹੈ ਜੀ ਬਾਕੀ ਕਈ ਲੋਕ ਕੋਈ ਜਿਹੜੇ ਦਸ ਪਰਸੈਂਟ ਨੇ ਕੋਈ ਉਹਨਾਂ ਨੂੰ ਕਹਿ ਵੀ ਦਿੰਦਾ ਵੀ ਨਹੀਂ ਤੁਸੀਂ ਵੀ ਆਹ ਵੀ ਕਰੋ ਚਲੋ ਠੀਕ ਹੈ ਤੁਸੀਂ ਸਿਆਣਿਆਂ ਵਾਲੇ ਪਾਸੇ ਜਾਓ ਠੀਕ ਹੈ ਅਤੇ ਤੁਸੀਂ ਵੀ ਆਪਣਾ ਡਾਕਟਰੀ ਇਲਾਜ ਵੀ ਕਰ ਕਰਵਾਓ ਡਾਕਟਰੀ ਇਲਾਜ ਘੱਟ ਜਾਂਦੇ ਨੇ ਸਿਆਣਿਆਂ ਕੋਲ ਜ਼ਿਆਦਾ ਜਾਣਾ ਜਿੰਨੇ ਪੈਸੇ ਪੈਸੇ ਸਗੋਂ ਡਾਕਟਰ ਵਾਲੇ ਪਾਸੇ ਅਸੀਂ ਕਹਿੰਦੇ ਵੀ ਚੱਲ ਵੀ ਘੱਟ ਲੱਗਣਗੇ ਉਹ ਕਹਿੰਦੇ ਨੇ ਨਹੀਂ ਨਹੀਂ ਸਾਨੂੰ ਤਾਂ ਕਿਸੇ ਨੇ ਇਹ ਦੱਸਿਆ ਤੂੰ ਚੁਰਾਹੇ ਤੋਂ ਟੱਪ ਗਈ ਹੈ ਤੂੰ ਤੈਨੂੰ ਉੱਪਰਲੀ ਹਵਾ ਆ ਗਈ ਹੈ ਤੂੰ ਪਿੱਪਲ ਥੱਲੇ ਟੱਪ ਗਈ ਹੈ ਤੈਨੂੰ ਇਸ ਤਰ੍ਹਾਂ ਦੀ ਹਵਾ ਆਈ ਪਈ ਹੈ ਉਹ ਛੱਤੀ ਸਿਆਣਿਆਂ ਦੇ ਢੁਕ ਚਲੇ ਜਾਣਗੇ ਪਰ ਉਹ ਆਪਣੇ ਇਲਾਜ਼ ਡਾਕਟਰੀ ਇਲਾਜ ਨਹੀਂ ਕਰਾਉਣਗੇ ਜੇ ਮੰਨ ਲਓ ਕੋਈ ਜਿਵੇਂ ਦਿਮਾਗੀ ਪ੍ਰੋਬਲਮ ਹੈ ਜਾਂ ਕਿਸੇ ਦੀ ਡਾਕਟਰ ਕੋਲ ਦਿਖਾ ਲਈਏ ਜਾਂ ਮਤਲਬ ਕਿ ਕੋਈ ਵੀ ਵੈਸੇ ਕੋਈ ਬ ਮਤਲਬ ਬੱਚੇ ਦਾ ਕੋਈ ਜਿਵੇਂ ਮਾਹੌਲ ਜਾਂ ਕੋਈ ਬੁਖਾਰ ਹੈ ਜਾਂ ਕੋਈ ਝਾੜਾ ਲਵਾਣਾ ਜਾਂ ਕੋਈ ਵੈਸੇ ਮਤਲਬ ਵੀ ਪਰ ਉਸ ਵਾਲੇ ਪਾਸੇ ਨਹੀਂ ਜਾਣਗੇ ਇਸ ਤਰ੍ਹਾਂ ਦਾ ਅੰਧ ਵਿਸ਼ਵਾਸ ਸਾਡੀ ਕਲੋਨੀ 'ਚ ਜ਼ਿਆਦਾ ਹੀ ਦੇਖਣ ਨੂੰ ਮਿਲਦਾ ਹਾਂਜੀ ਸਰ ਸਰ ਜੀ ਸਭ ਤੋਂ ਜ਼ਿਆਦਾ ਤਾਂ ਪਹਿਲੀ ਗੱਲ ਤਾਂ ਜਿਵੇਂ ਅੱਜ ਕੱਲ੍ਹ ਟੀਕੇ ਚੱਲ ਰਹੇ ਨੇ ਨਸ਼ਿਆਂ ਵਾਲੇ ਟੀਕੇ ਜਿਹੜੇ ਬੱਚੇ ਲਾ ਰਹੇ ਨੇ ਸਾਰਿਆਂ ਤੋਂ ਜ਼ਿਆਦਾ ਅੱਜ ਕੱਲ੍ਹ ਤਾਂ ਉਹ ਚੱਲੀ ਜਾਂਦੇ ਨੇ ਅੰਧ ਵਿਸ਼ਵਾਸ ਉਹਦੇ ਵਿੱਚ ਬੜੇ ਫਿਰ ਉਹ ਕਹਿੰਦੇ ਨੇ ਅਸੀਂ ਇਹਦੇ ਨਾਲ ਵੀ ਠੀਕ ਹੋ ਜਾਵਾਂਗੇ ਅੰਧ ਵਿਸ਼ਵਾਸ ਵੀ ਮੇਰੇ ਹਿਸਾਬ ਨਾਲ ਤਾਂ ਵੀ ਲੋਕਾਂ ਨੂੰ ਵੀ ਪੜ੍ਹੇ ਲਿਖੇ ਸਗੋਂ ਹੋਣਾ ਚਾਹੀਦਾ ਉਹ ਸਗੋਂ ਇੱਧਰਲੇ ਪਾਸੇ ਜ਼ਿਆਦਾ ਭੱਜਦੇ ਪਏ ਨੇ ਵੈਸੇ ਚਲੋ ਮੰਨ ਲਓ ਜਿਵੇਂ ਕਿਸੇ ਨੇ ਕਹਿ ਦਿੱਤਾ ਵੀ ਤੂੰ ਉਧਰਲੇ ਪਾਸੇ ਚਲੀ ਜਾ ਫਿਰ ਉੱਥੋਂ ਠੀਕ ਹੋ ਜਾਏਗਾ ਉਹ ਸਿਆਣੇ ਕੋਲ ਚਲੀ ਜਾ ਤੋ ਉੱਥੇ ਠੀਕ ਹੋ ਜਾਏਗਾ ਵੀ ਮੰਨ ਲਓ ਜਿਵੇਂ ਵੀ ਕਿਸੇ ਵੀ ਵੀ ਬੱਚਾ ਨਸ਼ਿਆਂ ਦੇ ਵਿੱਚ ਹਾਂਜੀ ਹਾਂਜੀ ਜਿਵੇਂ ਕੋਈ ਬੱਚਾ ਕੋਈ ਨਸ਼ਾ ਕਰ ਰਿਹਾ ਤਾਂ ਉਹ ਮਤਲਬ ਜਿਵੇਂ ਡਾਕਟਰਾਂ ਦੇ ਕੋਲ ਨਹੀਂ ਜਾਣਗੇ ਉਹ ਕਹਿੰਦੇ ਬਾਬਿਆਂ ਕੋਲ ਜਾ ਕੇ ਕਹਿਣਗੇ ਸਾਡੇ ਬੱਚੇ ਦਾ ਨਸ਼ਾ ਛੁਡਾ ਦੇ ਬਾਬੇ ਦੱਸੋ ਭਲਾ ਨਸ਼ਾ ਛੁਡਾਉਣਗੇ ਅੱਜ ਕੱਲ੍ਹ ਇੰਨੇ ਇੰਨੇ ਸਾਇੰਸ ਟੈਕਨੋਲੋਜੀ ਚਲੀ ਜਾਂਦੀ ਹੈ ਉਹ ਨਹੀਂ ਵੇਖਣਾ ਉਹਨਾਂ ਨੇ ਸਿਆਣਿਆਂ ਕੋਲ ਧਾਗੇ ਬਨਵਾ ਕੇ ਲੈ ਆਉਣਗੇ ਫਿਰ ਜਦੋਂ ਨਹੀਂ ਕਿ ਉਧਰ ਨਹੀਂ ਧਿਆਨ ਪਿਆ ਉਹ ਫਿਰ ਕਿਤੇ ਹੋਰ ਪਾਸੇ ਚਲੇ ਜਾਣਗੇ ਮਤਲਬ ਕਿ ਇਹ ਹੈ ਵੀ ਅੰਧ ਵਿਸ਼ਵਾਸ ਦੇ ਵਿੱਚ ਵੀ ਸਾਡਾ ਤਾਂ ਜਿਹੜਾ ਏਰੀਆ ਨਾ ਰਾਧਾ ਸੁਆਮੀ ਕਲੋਨੀ ਮੰਨ ਲਓ ਜਾਂ ਵੀ ਸਾਡੇ ਨਾਲ ਪਰਲੇ ਪਾਸੇ ਜਿਹੜੀ ਇੱਕ ਹੋਰ ਕਲੋਨੀ ਹੈ ਅਤੇ ਇਹ ਮਤਲਬ ਕਿ ਇੰਨਾ ਕੁ ਅੰਧ ਵਿਸ਼ਵਾਸ ਕਰੀ ਬੈਠੇ ਨੇ ਵੀ ਇਹਨਾਂ ਨੂੰ ਵੇਖ ਵੇਖ ਕੇ ਵੀ ਜਿਹੜੇ ਕੋਈ ਸਿਆਣਾ ਬੰਦਾ ਬੈਠਾ ਹੁੰਦਾ ਉਹ ਵੀ ਉਹਨਾਂ ਵਾਲੇ ਪਾਸੇ ਭੱਜੀ ਜਾਂਦੇ ਕਿਹਨੂੰ ਸਮਝਾਈਏ ਅਤੇ ਕਿਹਨੂੰ ਨਾ ਸਮਝਾਈਏ ਇੰਨਾ ਕੁ ਹਾਂਜੀ ਠੀਕ ਹੈ ਸਰ ਜੀ